ਹੈਲੋ ਹਾਂਜੀ ਓਲਾ ਕੈਬ ਤੋਂ ਗੱਲ ਕਰ ਰਹੇ ਹੋ ਜੀ ਹਾਂਜੀ ਹਾਂਜੀ ਹਾਂਜੀ ਸਰ ਮੈਂ ਹਰਦਿਆਲ ਸਿੰਘ ਗੱਲ ਕਰ ਰਿਹਾ ਹੈਗਾ ਹਾਲ ਹੀ ਵਿੱਚ ਪਿਛਲੇ ਦਿਨੀਂ ਮੈਂ ਤੁਹਾਡੀ ਕੈਬ ਸੀ ਜੋ ਬੁੱਕ ਕਰਵਾਈ ਸੀ ਚੰਡੀਗੜ੍ਹ ਦੇ ਵਿੱਚ ਹਾਂਜੀ ਹਾਂਜੀ ਸਰ ਉਹਦੇ ਰਿਕਾਰਡਿੰਗ ਸਰ ਸ਼ਿਕਾਇਤ ਹੈਗੀ ਹਾਂਜੀ ਸਰ ਇੱਕ ਤਾਂ ਜਿਹੜੀ ਤੁਹਾਡੀ ਜੋ ਗੱਡੀ ਸੀ ਤੁਹਾਡਾ ਵਾਹਨ ਸੀਗਾ ਉਹਦੀ ਹਾਲਤ ਸੀ ਜੋ ਬਹੁਤ ਖ਼ਰਾਬ ਸੀਗੀ ਸ਼ੀਟਾਂ ਉਹਦੀਆਂ ਬਿਲਕੁਲ ਫਟੀਆਂ ਸੀਗੀਆਂ ਉਹਦੇ ਵਿੱਚੋਂ ਮੁਸ਼ਕ ਆ ਰਿਹਾ ਸੀਗਾ ਸ਼ੀਟਾਂ ਦੇ ਵਿੱਚੋਂ ਬਿਲਕੁਲ ਕੋਈ ਸਫਾਈ ਨਹੀਂ ਸੀ ਗੱਡੀ ਦੇ ਵਿੱਚ ਅਤੇ ਉੱਪਰੋਂ ਜੋ ਡਰਾਈਵਰ ਸੀਗਾ ਜੀ ਤੁਹਾਡਾ ਉਹ ਬਹੁਤ ਹੀ ਰੁੱਖੇ ਸੁਭਾਅ ਦਾ ਸੀਗਾ ਉਹ ਗੱਲ ਗੱਲ 'ਤੇ ਗਾਲ੍ਹਾਂ ਵੀ ਕੱਢ ਰਿਹਾ ਸੀਗਾ ਹਾਂਜੀ ਹਾਂਜੀ ਹਾਂਜੀ ਮਤਲਬ ਵੀ ਬਹੁਤ ਨਹੀਂ ਨਹੀਂ ਜੀ ਸਾਡਾ ਜੋ ਵੀ ਐਕਸਪੀਰੀਅੰਸ ਰਿਹਾ ਉੱਥੇ ਉਹ ਚੰਗਾ ਨਹੀਂ ਰਿਹਾ ਹਾਂਜੀ ਹਾਂਜੀ ਸਰ ਇਹਦੇ ਸੰਬੰਧ ਵਿੱਚ ਤੁਸੀਂ ਕੋਈ ਵੀ ਉਹਦੇ ਵਿਰੁੱਧ ਕਾਰਵਾਈ ਕਰ ਸਕਦੇ ਹੋ ਤਾਂ ਕਰੋ ਠੀਕ ਹੈ ਜੀ ਮਤਲਬ ਬਿਲਕੁਲ ਵੀ ਜੋ ਵੀ ਸਾਡਾ ਤਜਰਬਾ ਰਿਹਾ ਉਸ ਡਰਾਈਵਰ ਦੇ ਨਾਲ ਜਾਂ ਤੁਹਾਡੀ ਗੱਡੀ ਦੇ ਨਾਲ ਬਿਲਕੁਲ ਹੀ ਖ਼ਰਾਬ ਸੀਗਾ ਹਾਂਜੀ ਗੱਡੀ ਦੇ ਵਿੱਚ ਬਿਲਕੁਲ ਸਫਾਈ ਨਹੀਂ ਸੀ ਅਤੇ ਡਰਾਈਵਰ ਦੀ ਬੋਲੀ ਸੀ ਜੋ ਬਹੁਤ ਹੀ ਭੱਦੀ ਬੋਲੀ ਯੂਜ਼ ਕਰ ਰਿਹਾ ਸੀ ਉਹ ਹਾਂਜੀ ਹਾਂਜੀ ਠੀਕ ਹੈ ਜੀ ਓਕੇ ਜੀ ਧੰਨਵਾਦ